ਹਾਂ ਮੈਂ ਸੈਲਾਨੀਆਂ ਨਾਲ ਗੱਲਬਾਤ ਕੀਤੀ ਹੈ ਮੈਨੂੰ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗਿਆ ਮੈਂ ਇਹਨਾਂ ਤੋਂ ਸਿੱਖਿਆ ਵੀ ਅਤੇ ਮੈਂ ਇਹਨਾਂ ਨੂੰ ਆਪਣੇ ਬਾਰੇ ਕੁਝ ਦੱਸਿਆ ਵੀ ਇੱਕ ਵਾਰ ਮੈਂ ਛੁੱਟੀਆਂ ਵਿੱਚ ਹਿਮਾਚਲ ਗਈ ਸੀ ਅਤੇ ਉੱਥੇ ਮੈਨੂੰ ਕੁਝ ਕੁ ਸੈਲਾਨੀ ਮਿਲੇ ਮੈਨੂੰ ਉਹਨਾਂ ਨਾਲ ਗੱਲ ਕਰਕੇ ਬਹੁਤ ਹੀ ਵਧੀਆ ਲੱਗਿਆ ਉਹਨਾਂ ਦਾ ਸੁਭਾਅ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਇੱਧਰ ਥੋੜ੍ਹੀ ਜਿਹੀ ਗਰਮੀ ਤਾਂ ਜ਼ਰੂਰ ਹੈ ਪਰ ਸਾਡੇ ਇੱਥੇ ਲੋਕ ਦਿਲ ਦੇ ਮਾੜੇ ਨਹੀਂ ਹਨ ਲੋਕ ਇੱਕ ਦੂਜੇ ਦੀ ਮਦਦ ਲਈ ਆਪਣਾ ਕੰਮ ਵੀ ਵਿਚਾਲੇ ਛੱਡ ਦਿੰਦੇ ਹਨ ਦੂਜੇ ਦੀ ਸਹਾਇਤਾ ਲਈ ਭਾਵੇਂ ਉਸਨੂੰ ਜਾਣਦੇ ਹਨ ਭਾਵੇਂ ਉਸਨੂੰ ਨਹੀਂ ਜਾਣਦੇ ਅਤੇ ਸਾਡੇ ਇੱਧਰ ਦੇ ਲੋਕ ਦੂਜਿਆਂ ਨੂੰ ਆਪਣਾ ਹੀ ਸਮਝ ਕੇ ਉਹਨਾਂ ਦੀ ਮਦਦ ਕਰਦੇ ਹਨ